ਆਪਣਾ ਭਾਰਤ ਆਜ਼ਾਦ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਹੋਇਆ ਸੀ ਉਸ ਤੋਂ ਭਾਰਤ ਵਿੱਚ ਉਸ ਟਾਈਮ ਭਾਰਤ ਵਿੱਚ ਬਹੁਤ ਦੰਗੇ ਹੋਏ ਸਨ ਇੱਕ ਦੂਜੇ ਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਸੀ ਅੰਗਰੇਜ਼ ਭਾਰਤ ਉੱਪਰ ਆਪਣਾ ਰਾਜ ਕਰਨਾ ਚਾਹੁੰਦੇ ਸਨ ਅਤੇ ਤਿੰਨ ਨੇਤਾ ਅਤੇ ਅੰਗਰੇਜ਼ਾਂ ਨੂੰ ਦਬਾਉਣ ਵਾਸਤੇ ਤਿੰਨ ਨੇਤਾ ਪੈਦਾ ਹੋਏ ਸ਼ਹੀਦ ਭਗਤ ਸਿੰਘ ਸਰਾਭਾ ਰਾਜਗੁਰੂ ਅਤੇ ਸੁਖਦੇਵ ਇਹਨਾਂ ਦੇ ਇਹਨਾਂ ਨੇ ਤਿੰਨ ਨੌਜਵਾਨਾਂ ਨੇ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਸੀ ਅਤੇ ਉਹਨਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਿਆ ਸੀ ਇਨ੍ਹਾਂ ਤਿੰਨ ਨੌਜਵਾਨਾਂ ਨੇ ਆਪਣੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ ਸੀ ਇਨ੍ਹਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਇਸ ਘਟਨਾ ਨੂੰ ਅਸੀਂ ਭੁੱਲ ਨਹੀਂ ਸਕਦੇ ਜਦੋਂ ਅਸੀਂ ਇਸ ਘਟਨਾ ਨੂੰ ਯਾਦ ਕਰਦੇ ਹਾਂ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਇਸ ਘਟਨਾ ਨੂੰ ਹਿਸਟਰੀ ਵਿੱਚ ਲਿਖਿਆ ਗਿਆ ਹੈ ਆਉਣ ਵਾਲੀ ਜਨਰੇਸ਼ਨ ਜੋ ਕਿ ਇਸ ਨੂੰ ਪੜ੍ਹ ਸਕੇ ਆਜ਼ਾਦੀ ਲਈ ਗਾਂਧੀ ਜੀ ਵੀ ਲੜੇ ਸਨ ਅਤੇ ਜਵਾਹਰ ਲਾਲ ਨਹਿਰੂ ਦਾ ਵੀ ਇਸ ਆਜ਼ਾਦੀ ਵਿੱਚ ਯੋਗਦਾਨ ਪਾਇਆ ਸੀ